ਹਾਂ ਜੀ ਨੌਜਵਾਨ ਪੀੜ੍ਹੀ ਨੂੰ ਪੇਂਡੂ ਖੇਤਰਾਂ ਵਿੱਚ ਜੀਵਨ ਸਾਥੀ ਪ੍ਰਾਪਤ ਕਰਨ ਵਿੱਚ ਬਹੁਤ ਹੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਲੋਕ ਸ਼ਹਿਰਾਂ ਵਿੱਚ ਵੱਸਣਾ ਪਸੰਦ ਕਰਦੇ ਹਨ ਕਿਉਂਕਿ ਸ਼ਹਿਰਾਂ ਵਿੱਚ ਸਾਰੀ ਸਹੂਲਤ ਹੁੰਦੀ ਹੈ ਜੋ ਲੋਕ ਜੋਬ ਵਗੈਰਾ ਕਰਦੇ ਹਨ ਉਹਨਾਂ ਸ਼ਹਿਰਾਂ ਵਿੱਚ ਰਹਿ ਕੇ ਜੋਬ ਕਰਨਾ ਠੀਕ ਲੱਗਦਾ ਹੈ ਉਹ ਸ਼ਹਿਰਾਂ ਵਿੱਚ ਰਹਿ ਕੇ ਜੋਬ 'ਤੇ ਜਾਣ ਨੂੰ ਬੱਸਾਂ ਦਾ ਬੱਸਾਂ ਦੀ ਪ੍ਰੋਬਲਮ ਨਹੀਂ ਆਉਂਦੀ ਪਿੰਡਾਂ ਵਿੱਚ ਬੱਸਾਂ ਨਹੀਂ ਜਾਂਦੀਆਂ ਇਸ ਕਰਕੇ ਪਹਿਲਾਂ ਉਹਨਾਂ ਨੂੰ ਬੱਸ ਸਟੈਂਡ ਆਉਣਾ ਪੈਂਦਾ ਹੈ ਫਿਰ ਬੱਸ ਲਈ ਜਾਂਦੀ ਹੈ ਅਤੇ ਆਉਣ ਜਾਣ ਵਿੱਚ ਜ਼ਿਆਦਾ ਟਾਈਮ ਲੱਗਦਾ ਹੈ ਅੱਜ ਕੱਲ੍ਹ ਦੀ ਜਨਰੇਸ਼ਨ ਪਿੰਡਾਂ ਵਿੱਚ ਰਹਿਣਾ ਪਸੰਦ ਨਹੀਂ ਕਰਦੀ ਇਸ ਕਰਕੇ ਸ਼ਹਿਰਾਂ ਵਿੱਚ ਰਹਿਣਾ ਪਸੰਦ ਕਰਦੇ ਹਨ ਜੇਕਰ ਕੋਈ ਆਪਾਂ ਮਠਿਆਈ ਜਾਂ ਸਬਜ਼ੀ ਕੋਈ ਵੀ ਹੋਰ ਚੀਜ਼ ਲੈਣੀ ਹੋਵੇ ਅਸੀਂ ਜਲਦੀ ਤੋਂ ਜਲਦੀ ਬਜ਼ਾਰ ਵਿੱਚ ਜਾ ਕੇ ਚੀਜ਼ ਲਿਆ ਸਕਦੇ ਹਾਂ ਪਿੰਡਾਂ ਵਿੱਚ ਜੀਨਜ਼ ਪਾਉਣੀਆ ਵਧੀਆ ਨਹੀਂ ਮੰਨਦੇ ਅਤੇ ਪਿੰਡਾਂ ਵਿੱਚ ਸੂਟਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ ਸ਼ਹਿਰਾਂ ਵਿੱਚ ਜੀਨਜ਼ ਪਾਉਣੀਆ ਵਧੀਆ ਮੰਨਦੇ ਹਨ